ਮੈਨੂੰ ਉਦਾਸ ਗੀਤ ਬਹੁਤ ਪਸੰਦ ਹਨ ਜਿਵੇਂ ਕਿ ਦੁਰਗਾ ਰੰਗੀਲਾ ਸਰਦੂਲ ਸਿੰਕਦਰ ਦੁਰਗਾ ਰੰਗੀਲਾ ਦਾ ਇੱਕ ਗਾਣਾ ਮੈਨੂੰ ਬਹੁਤ ਪਸੰਦ ਹੈ ਜਿਸਦਾ ਨਾਮ ਵਿਗ ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ ਬਹੁਤ ਪਸੰਦ ਹੈ ਜੋ ਉਦਾਸ ਗੀਤ ਹੈ ਮੈਂ ਅਕਸਰ ਸੁਣਦਾ ਰਹਿੰਦਾ ਜਦੋਂ ਕਿਤੇ ਜਾਣਾ ਆਉਣਾ ਆਉਂਦੇ ਹੋਏ ਰਸਤੇ 'ਚ ਟੀ ਵੀ 'ਤੇ ਫ਼ੋਨ 'ਤੇ ਚਲਦਾ ਰਹਿੰਦਾ ਹੈ ਸਾਡੀ ਪਿੱਠ 'ਤੇ ਕਿੰਨੇ ਵਾਰ ਹੋਏ ਸਭ ਕੀਤੇ ਜੀਗਰੀ ਯਾਰਾਂ ਨੇ ਬਹੁਤ ਵਾਰ ਸੁਣਿਆ ਹਮੇਸ਼ਾ ਹੀ ਸੁਣਦੇ ਹਾਂ ਅਤੇ ਨੂਰ ਤੇਰੇ ਨੈਣਾਂ ਦਾ ਅਕਸਰ ਸੁਣੀ ਦਾ ਗਾਣਾ ਬਹੁਤ ਵਧੀਆ ਲੱਗਦਾ ਸੁਣਕੇ ਮਾਸਟਰ ਸਲੀਮ ਦੇ ਬਹੁਤ ਗਾਣੇ ਹੈ ਦੁੱਖ ਦੇਣੀਏ ਨੀ ਕਿਹੜਾ ਦੁੱਖ ਦੇਣ ਆਈ ਏ ਸਰਦੂਲ ਸਿਕੰਦਰ ਸਾਬ੍ਹ ਦਾ ਓਸ ਕੁੜੀ ਨੇ ਬਹੁਤ ਸੁਣਦੇ ਹੈ ਹਮੇਸ਼ਾ ਹੀ ਸੁਣਦੇ ਰਹਿੰਦੇ ਹੈ ਬਹੁਤ ਅੱਛੇ ਲੱਗਦੇ ਐ ਗਾਣੇ